ਹੈਲੋ ਕਿਵੇਂ ਆ ਰਾਜਵੀਰ ਬਹੁਤ ਵਧੀਆ ਯਾਰ ਉਹ ਨਾ ਮੈਂ ਯੂਨੀਵਰਸਿਟੀ ਤੋਂ ਹੋਸਟਲ ਤੋਂ ਸ਼ਿਫਟ ਹੋ ਰਿਹਾ ਸੀ ਪੰਜਾਬੀ ਯੂਨੀਵਰਸਿਟੀ ਤੋਂ ਅਤੇ ਮੈਂ ਕੋਈ ਪੀ ਜੀ ਦੇਖਣਾ ਯੂਨੀਵਰਸਿਟੀ ਦੇ ਹਾਂ ਨੇੜੇ ਤੇੜੇ ਹੀ ਕੋਈ ਪੀ ਜੀ ਹੋਏ ਜੇ ਸਾਹਮਣੇ ਮਿਲ ਜੇ ਤਾਂ ਜ਼ਿਆਦਾ ਵਧੀਆ

ਮੈਨੂੰ ਕੋਈ ਵੀ ਚੱਲੂਗਾ ਦੋਨਾਂ 'ਚੋਂ ਬਸ ਮੇਰੀ ਇਹ ਰਿਕੁਆਇਰਮੈਂਟ ਜਿਹੜਾ ਇਹ ਰੂਮ ਹੋਏ ਉਸ 'ਚ ਵੈਂਟੀਲੇਸ਼ਨ ਵਧੀਆ ਹੋਵੇ ਉਹਦੇ 'ਚ ਸਨਲਾਈਟ ਵਗੈਰਾ ਆਉਂਦੀ ਹੋਏ

ਅੱਛਾ ਗੀਜਰ ਅਤੇ ਏ ਸੀ ਦਾ ਬਿੱਲ ਅੱਡ ਉਹ ਆ ਠੀਕ ਆ ਹਾਂ ਹਾਂ ਮਤਲਬ ਸਮਝ ਗਿਆ ਅੱਛਾ ਅੱਛਾ ਮਤਲਬ ਪੰਤਾਲੀ ਸੌ ਰੁਪਇਆ ਰੈਂਟ ਹੋ ਗਿਆ ਅਤੇ ਉਸ ਤੋਂ ਇਲਾਵਾ ਬਿਜਲੀ ਦਾ ਉੱਪਰ ਦਾ ਠੀਕ ਹੈ ਅਤੇ ਪਾਣੀ ਦਾ ਕੋਈ ਬਿੱਲ ਹੋਉਗਾ ਨਾਲ ਅੱਛਾ ਅੱਛਾ ਓਕੇ ਅਤੇ ਉਸ 'ਚ ਪਾਣੀ ਦਾ ਬਿੱਲ ਵਗੈਰਾ ਵੀ ਕੋਈ ਨਾਲ ਹੁੰਦਾ ਰੈਂਟ ਦੇ ਵਿੱਚ ਅੱਛਾ ਅੱਛਾ

ਅਤੇ ਪਰ ਐਦਾਂ ਹੈਗਾ ਕੋ ਐਦਾਂ ਹੈਗਾ ਕੋਈ ਰਸਿਟ੍ਰਿਕਸ਼ਨ ਨਾ ਹੋਵੇ ਵੀ ਜਿਵੇਂ ਕਈ ਹੁੰਦੇ ਨੇ ਅੱਠ ਵਜੇ ਤੱਕ ਪੀ ਜੀ ਵਾਪਸ ਪਹੁੰਚਣਾ ਗੇਟ ਬੰਦ ਕਰ ਦਿੰਦੇ ਅਤੇ ਕੋਈ ਬ੍ਰੇਕਫਾਸਟ ਡਿਨਰ ਵਗੈਰਾ ਦਾ ਪ੍ਰੋਗਰਾਮ ਵੀ ਹੋ ਜਾਵੇ ਅੱਛਾ ਹਾਂ ਹਾਂ ਹੈ ਤੇਰੀ ਜਾਣ ਪਛਾਣ 'ਚ ਕੋਈ ਹੈ ਅਤੇ ਨਾਲ ਚੱਲੀ ਫਿਰ ਮੇਰੇ ਹਾਂ ਹਾਂ ਹਾਂ ਹੈਗਾ ਅੱਛਾ ਕੱਲ੍ਹ ਨੂੰ ਚੱਲਦੇ ਹਾਂ ਫਿਰ ਮੈਂ ਆਉਂਦਾ ਕੱਲ੍ਹ ਨੂੰ ਅੱਛਾ ਚੱਲ ਠੀਕ ਹਾਂ ਕੱਲ੍ਹ ਨੂੰ ਮਿਲਦੇ ਆ ਫਿਰ ਆਉਂਦਾ ਮੈਂ ਤੇਰੇ ਕੋਲ ਠੀਕ ਹੈ